ਪੰਜਾਬ ਵਿੱਚ ਬਾਹਰ ਜਾਣ ਲਈ ਜਿਹੜੀ ਸਭ ਤੋਂ ਵਧੀਆ ਜਗ੍ਹਾ ਮੈਨੂੰ ਲੱਗਦੀ ਹੈ ਉਹ ਹੈਗਾ ਨੈਣਾ ਦੇਵੀ ਕਿਉਂਕਿ ਉਹ ਇੱਕ ਤਾਂ ਪਹਾੜਾਂ ਦੇ ਵਿੱਚ ਵਸੀ ਹੋਈ ਹੈ ਅਤੇ ਉੱਥੇ ਨਾ ਤਾਂ ਜ਼ਿਆਦਾ ਗਰਮੀ ਹੁੰਦੀ ਹੈ ਕਿਉਂਕਿ ਉੱਥੇ ਜਦੋਂ ਜਾਂਦੇ ਹਾਂ ਤਾਂ ਉੱਥੇ ਮੈਂ ਜਿਹੜੀ ਕੁਦਰਤੀ ਸੁੰਦਰਤਾ ਉਹਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੁੰਦੀ ਹਾਂ ਕਿਉਂਕਿ ਸਾਰਾ ਟਾਈਮ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਬਹੁਤ ਜ਼ਿਆਦਾ ਪ੍ਰਦੂਸ਼ਿਤ ਏਰੀਆ ਹੈ ਅਤੇ ਸਾਰਾ ਟਾਈਮ ਉੱਥੇ ਬਹੁਤ ਜ਼ਿਆਦਾ ਵਹੀਕਲਸ ਦੀ ਆਵਾਜ਼ਾਂ ਆਉਂਦੀਆਂ ਹਨ ਜੋ ਕਿ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀਆਂ ਹਨ ਅਤੇ ਮੈਂ ਆਪਣੇ ਮਾਇੰਡ ਨੂੰ ਥੋੜ੍ਹਾ ਜਿਹਾ ਰਿਲੈਕਸ ਕਰਵਾਉਣ ਵਾਸਤੇ ਮੈਂ ਹਮੇਸ਼ਾਂ ਉੱਥੇ ਨੈਣਾਂ ਦੇਵੀ ਜਾਣਾ ਪਸੰਦ ਕਰਦੀ ਹਾਂ ਕਿਉਂਕਿ ਉੱਥੇ ਦਾ ਜਿਹੜਾ ਵਾਤਾਵਰਨ ਹੈ ਬਹੁਤ ਹੀ ਸਾਫ ਅਤੇ ਸ਼ਾਂਤੀ ਵਾਲ਼ਾ ਵਾਤਾਵਰਨ ਹੈ ਅਤੇ ਜਦੋਂ ਵੀ ਉੱਥੇ ਜਾਂਦੇ ਹਾਂ ਤਾਂ ਉੱਥੋਂ ਤੋਂ ਵਾਪਿਸ ਆਉਣ ਨੂੰ ਕਦੇ ਦਿਲ ਨਹੀਂ ਕਰਦਾ ਕਿਉਂਕਿ ਜਿੰਨੀ ਉੱਚਾਈ 'ਤੇ ਅਸੀਂ ਜਾਂਦੇ ਹਾਂ ਉੱਥੇ ਜਿਹੜੀ ਹਰਿਆਲੀ ਹੈ ਉਹ ਇੰਨੀ ਸੋਹਣੀ ਲੱਗਦੀ ਜਾਂਦੀ ਹੈ ਕਿ ਦਿਲ ਕਰਦਾ ਹੈ ਕਿ ਅਸੀਂ ਉੱਥੇ ਹੀ ਰਹਿਣਾ ਸ਼ੁਰੂ ਕਰ ਦਈਏ